ਹੈਲੋ ਹਾ ਹਾਂਜੀ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਹਾਂਜੀ ਹਾਂਜੀ ਦੱਸੋ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੁਸੀਂ ਠੀਕ ਹੈ ਠੀਕ ਹੈ ਤੁਸੀਂ ਕੋਈ ਆਪਣੇ ਨਿਊਜ਼ ਪੇਪਰ 'ਚ ਕਾਲਮ ਵਗੈਰਾ ਬਣਾਉਣਾ ਹੋਣਾ ਹੈ ਨਾ ਹਾਂਜੀ ਠੀਕ ਹੈ ਹਾਂਜੀ ਹਾਂ ਜਿਵੇਂ ਆਪਣੇ ਇੱਧਰ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਹੈ ਹੁਣ ਜਿਵੇਂ ਆਪਣੇ ਦੇਖੋ ਆਪਣੇ ਬਿਆਸ ਅਤੇ ਰਾਵੀ ਦਰਿਆ ਦਾ ਸੰਗਮ ਹੁੰਦਾ ਹਰੀਕੇ ਪੱਤਣ ਜਿਵੇਂ ਉੱਥੇ ਸਤਲੁਜ ਦਰਿਆ ਉਹ ਸਿਰਫ਼ ਸਤਲੁਜ ਦਰਿਆ ਹੀ ਅੱਗੇ ਜਾਂਦਾ ਪਾਕਿਸਤਾਨ ਨੂੰ ਵੀ ਵੀ ਆਪਾਂ ਇੱਧਰੋਂ ਪਾਣੀ ਵਗੈਰਾ ਛੱਡਦੇ ਹਰੀਕੇ ਪੱਤਣ ਤੋਂ ਫਿਰ ਉੱਥੋਂ ਹੀ ਦੋ ਜਿਵੇਂ ਕਿ ਆਪਣੀਆਂ ਨਹਿਰਾਂ ਨਿੱਕਲਦੀਆਂ ਇੱਕ ਤਾਂ ਰਾਜਸਥਾਨ ਨਹਿਰ ਇੱਕ ਫਿਰੋਜ਼ਪੁਰ ਫੀਡਰ ਹੈ ਅਤੇ ਦੋ ਨਹਿਰਾਂ ਆਪਣੇ ਜਿਹੜਾ ਕਿ ਆਪਣੇ ਸਾਰੇ ਕਿਤੇ ਹਾਂਜੀ ਸਿੰਚਾਈ ਦਾ ਮਤਲਬ ਕੰਮ ਲਈ ਆਉਂਦੀਆਂ ਇੱਧਰ ਰਾਜਸਥਾਨ 'ਚ ਵੀ ਉਹ ਹੀ ਜਾਂਦੀਆਂ ਇੱਧਰ ਫਰੀਦਕੋਟ ਵੀ ਉਹ ਹੀ ਨਹਿਰਾਂ ਆਉਂਦੀਆਂ ਅਤੇ ਹਾਂ ਬਾਕੀ ਹੋਰ ਵੀ ਹਾਂਜੀ ਬਾਕੀ ਹੋਰ ਵੀ ਉੱਥੋਂ ਕਾਫ਼ੀ ਨਹਿਰ ਹੋਰ ਵੀ ਇੱਕ ਨਵੀਂ ਨਹਿਰ ਦਾ ਪ੍ਰੋਸੈਸ ਦਾ ਚੱਲਦਾ ਪਿਆ ਵੀ ਤੀਜੀ ਨਹਿਰ ਸ਼ਾਇਦ ਕੱਢਣ ਨੂੰ ਕ ਕਹਿੰਦੇ ਪਏ ਆ ਪਰ ਹਾਂਜੀ ਹਾਂਜੀ ਹਾਂਜੀ ਅਤੇ ਪੱਕੀ ਬਸ ਇਹ ਹੀ ਚੀਜ਼ਾਂ ਹੋਰ ਵੀ ਆਪਣੇ ਕਾਫ਼ੀ ਜਿਵੇਂ ਨਹਿਰਾਂ ਹੈਗੀਆਂ ਰੋਪੜ ਨੂੰ ਜਾਂਦੀ ਹੈ ਨਹਿਰ ਗੁਰਦਾਸਪੁਰ ਨਹਿਰ ਹੈ ਚਾਰੇ ਪਾਸੇ ਸਿੰਚਾਈ ਦੇ ਲਈ ਵਰਤੀਆਂ ਜਾਂਦੀਆਂ ਇਹ ਇਹਨਾਂ 'ਚ ਪਾਣੀ ਛੱਡ ਦੇ ਉੱਥੋਂ ਸਤਲੁਜ ਦਰਿਆ ਤੋਂ ਉੱਥੋਂ ਹੀ ਨਿੱਕਲੀਆਂ ਇਹ ਹਰੀਕੇ ਪੱਤਣ ਤੋਂ ਹਾਂਜੀ ਹਾਂ ਪਾਣੀ ਦੇ ਬਚਾਅ ਇਹ ਹੀ ਆ ਵੀ ਬਸ ਆਪਾਂ ਜ਼ਿਆਦਾ ਆਪਾਂ ਸਾਰਿਆਂ ਨੂੰ ਇਹ ਹੀ ਮੈਸੇਜ ਟ ਟਾਈਮ ਟੂ ਟਾਈਮ ਲਗਾਉਂਦੇ ਰਹਿੰਦੇ ਵੀ ਪਾਣੀ ਦਾ ਜ਼ਿਆਦਾ ਦੁਰਵਰਤੋਂ ਨਾ ਕਰੋ ਦੁਰਵਰਤੋ ਜਿੰਨੀ ਕੁ ਲੋੜ ਹੈ ਹੈ ਨਾ ਆਪਾਂ ਘਰਾਂ 'ਚ ਵੀ ਇਹ ਹੀ ਕਹਿ ਦਿੰਦੇ ਹਾਂ ਵੀ ਜਿੰਨੀ ਕੁ ਲੋੜ ਆ ਉੰਨਾ ਹੀ ਵਰਤੋ ਹੈ ਨਾ ਇਹ ਹੋ ਜਾਂਦਾ ਹੋਰ ਕੀ ਹੈ ਜੀ ਹਾਂਜੀ ਕਿਉਂਕਿ ਜਿਵੇਂ ਜੇ ਹੁਣ ਆਪਾਂ ਜ਼ਿਆਦਾ ਵਰਤੋਂ ਕਰਾਂਗੇ ਪਾਣੀ ਦੀ ਤਾਂ ਫਿਰ ਉਹ ਹੀ ਦਿੱਕਤ ਆਉਂਦੀ ਹੈ ਵੀ ਅਗਾਂਹ ਆਪਾਂ ਨੂੰ ਔਖਾ ਹੋਵੇਗਾ ਜੇ ਅਸੀਂ ਸਾਰਿਆਂ ਨੂੰ ਮੈਸੇਜ ਤਾਂ ਇਹ ਹੀ ਲਾਈਦੇ ਹੈ ਵਾਰ ਵਾਰ ਹਾਂ ਹਾਂਜੀ ਬਚਾਅ ਹੋਣਾ ਚਾਹੀਦਾ ਬਸ ਇਹ ਹੀ ਹੈ ਵੀ ਪਾਣੀ ਦਾ ਜਿੰਨੀ ਆਪਾਂ ਦੁਰਵਰਤੋਂ ਕਰਾਂਗੇ ਉਨਾਂ ਹੀ ਬਾਅਦ 'ਚੋ ਆਪਾਂ ਨੂੰ ਔਖਾ ਹੋਣਾ ਪੈਣਾ ਅਗਾਂਹ ਆਪਣੇ ਬੱਚਿਆਂ ਨੂੰ ਹੈ ਨਾ ਅਤੇ ਇਸ ਕਰਕੇ ਸਾਰਿਆਂ ਨੂੰ ਇਹ ਹੀ ਸਲਾਹ ਦੇਈ ਦੀ ਆ ਵੀ ਲਿਮਿਟ 'ਚ ਆਪਣਾ ਪਾਣੀ ਵਰਤੋ ਅਤੇ ਲਿਮਿਟ 'ਚ ਹੀ ਆਪਣੇ ਜੋ ਨਹਾਉਣ ਧੋਣ ਲਈ ਹੈ ਜਿਵੇਂ ਉਹਨਾਂ 'ਤੇ ਯੂਜ ਕਰੋ ਕੱਪੜੇ ਧੋਣ ਲਈ ਉਨ੍ਹਾਂ 'ਤੇ ਹੀ ਯੂਜ ਕਰੋ ਹੈ ਨਾ ਹਾਂ ਹਾਂ ਹੋਰ ਚੱਲੋ ਬਾਕੀ ਬਸ ਇਹ ਹੀ ਹੈ ਨਹਿਰਾਂ ਨੂਰਾਂ ਬਾਰੇ ਹਾਂਜੀ ਬਾਕੀ ਬਸ ਇਹ ਹੀ ਹੈ ਵੀ ਨਹਿਰਾਂ ਤਾਂ ਆਪਣੇ ਕਾਫ਼ੀ ਵਗਦੀਆਂ ਕਾਫ਼ੀ ਹੈਗੀਆਂ ਨਹਿਰਾਂ ਸਤਲੁਜ ਹੈ ਬਿਆਸ ਹੈ ਰਾਵੀ ਹੈ ਅਤੇ ਇਹਨਾਂ ਤੋਂ ਵੱਖ ਵੱਖ ਨਹਿਰਾਂ ਹਾਂਜੀ ਨਹਿਰਾਂ ਦਾ ਹੀ ਆਪਣੇ ਤਾਂ ਜ਼ਿਆਦਾ ਬੋਰਾਂ ਦਾ ਉਹ ਵੀ ਪਾਣੀ ਆਉਂਦਾ ਜੀ ਆਪਣਾ ਜਿਵੇਂ ਹੁਣ ਸਾਡੇ ਤੋਂ ਇੱਧਰ ਹਰੀਕੇ ਪੱਤਣ ਵੱਲ ਤਾਂ ਸਾਰਾ ਪਾਣੀ ਉਹ ਹੀ ਯੂਜ ਹੁੰਦਾ ਨਲਕਿਆ ਨੁਲਕਿਆਂ ਦਾ ਉੱਧਰ ਤਾਂ ਦੂਜਾ ਪਾਣੀ ਤਾਂ ਕਰ ਸਾਨੂੰ ਪਤਾ ਵੀ ਨਹੀਂ ਕੋਈ ਵਾਟਰ ਵਕਸ ਵਗੈਰਾ ਵਾਲਾ ਜੋ ਵੀ ਹੈ ਵੀ ਇਹ ਹੀ ਪੀਂਦੇ ਹਾਂ ਆਪਾਂ ਤਕਰੀਬਨ ਸਾਰਾ ਇਹ ਹੀ ਵਰਤਦੇ ਹਾਂ ਅਤੇ ਬਾਕੀ ਪਾਣੀ ਦੇ ਬਚਾਅ ਬਾਰੇ ਇਹ ਹੀ ਲੋਕਾਂ ਨੂੰ ਇਹ ਵੀ ਕਹੀਦਾ ਵੀ ਇਹਨੂੰ ਗੰਦਗੀ ਨਾ ਫੈਲਾਓ ਬਸ ਆਪਣਾ ਸਾਫ਼ ਸੁਥਰਾ ਰੱਖੋ ਇਸ ਨੂੰ ਕਿਉਂਕਿ ਆਪਾਂ ਪੀਂਦੇ ਹਾਂ ਇਸ ਨੂੰ ਵਰਤਦੇ ਹਾਂ ਅਤੇ ਹਾਂ ਬਸ ਤੁਸੀਂ ਬਸ ਇਹ ਹੀ ਠੀਕ ਹੈ ਬਸ ਓਕੇ ਹੈ ਨਾ ਬਾਕੀ ਠੀਕ ਆ ਬਸ ਇਸ ਲਈ ਤੁਸੀਂ ਆਪਣਾ ਬਣਾ ਕੇ ਰੱਖ ਲਿਓ ਯੂਸ ਵਗੈਰਾ ਹੈ ਨਾ ਠੀਕ ਹੈ ਜੀ ਓਕੇ ਓਕੇ

ਓਕੇ ਜੀ ਓਕੇ ਓਕੇ